ਇੱਕ ਨਵੰਬਰ ਉੱਨੀ ਸੌ ਸੱਤਰ ਵੀਹ ਜਨਵਰੀ ਦੋ ਹਜ਼ਾਰ ਬਾਈ ਨੌ ਫਰਵਰੀ ਦੋ ਹਜ਼ਾਰ ਇੱਕੀ ਦਸ ਜੁਲਾਈ ਉੱਨੀ ਸੌ ਨੜਿਨਵੇਂ ਪੰਦਰ੍ਹਾਂ ਅਗਸਤ ਦੋ ਹਜ਼ਾਰ ਪੰਜ